ਬਲਵਿੰਦਰ ਸਿੰਘ ਮੈਂ ਅਸਲ ਦੇ ਵਿੱਚ ਜਦੋਂ ਇਹ ਸੋਚਿਆ ਸੀ ਵੀ ਮੈਂ ਇੱਧਰ ਜਾਣਾ ਹੈ ਇਸ ਨੌਕਰੀ ਵੱਲ ਤਾਂ ਉਸ ਟਾਈਮ ਇਹ ਅੱਜ ਤੋਂ ਸੌਲ੍ਹਾਂ ਸਾਲ ਪਹਿਲਾਂ ਇਹਦੀ ਬਹੁਤ ਜ਼ਿਆਦਾ ਜਿਹੜਾ ਮਹੱਤਵਪੂਰਨ ਕਹਿ ਲਉ ਜਾਂ ਬਹੁਤ ਇਹਦੀ ਇੱਜਤ ਹੁੰਦੀ ਸੀ ਪੇਸ਼ੇ ਦੀ ਜਿਸ ਕਰਕੇ ਮੈਂ ਇੱਧਰ ਜਾਣ ਦਾ ਸੋਚਿਆ ਸੀ ਚਾਹੇ ਮੇਰੇ ਕੋਲ ਹੋਰ ਬਹੁਤ ਸਾਰੀਆਂ ਜਿਹੜੇ ਸੀਗੇ ਮੌਕੇ ਸੀਗੇ ਜਦ ਮੈਂ ਆਪਦੀ ਮ ਇਹਦੇ 'ਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਟਾਈਮ ਕੰਪਨੀਆਂ ਵੀ ਬੜੀਆਂ ਆਈਆਂ ਸਾਡੇ ਉੱਥੇ ਉਹਦੇ ਲਈ ਪਰ ਮੇਰਾ ਸ਼ੁਰੂ ਤੋਂ ਹੀ ਇਹ ਸੋਚਿਆ ਹੋਇਆ ਸੀਗਾ ਵੀ ਜਿਹੜੀਆਂ ਜਨਾਨੀਆਂ ਲਈ ਜਿਹੜੀ ਪ੍ਰੋਫੈਸਰ ਦੀ ਜੋਬ ਹੈ ਇਹ ਬੜੀ ਸੌਖੀ ਹੈ ਕਿਉਂਕਿ ਘਰੇਲੂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਵੀ ਅਸੀਂ ਭੱਜ ਨਹੀਂ ਸਕਦੇ ਜਨਾਨੀਆਂ ਦੇ ਉੱਤੇ ਬੱਚਿਆਂ ਦਾ ਘਰਦਿਆਂ ਦਾ ਸਾਰਿਆਂ ਦਾ ਬੜਾ ਬੋਝ ਹੁੰਦਾ ਅਤੇ ਇਸ ਕਰਕੇ ਮੇਰੇ ਪਿਤਾ ਜੀ ਨੇ ਹੀ ਮੈਨੂੰ ਇਹ ਕਿਹਾ ਸੀ ਵੀ ਬੇਟਾ ਬਹੁਤ ਵਧੀਆ ਨੌਕਰੀ ਆ ਤੁਸੀਂ ਇੱਧਰ ਚਲੇ ਜਾਓ ਅਤੇ ਮੈਂ ਸ਼ੁਰੂ ਤੋਂ ਇਹ ਸੋਚਿਆ ਹੋਇਆ ਸੀ ਵੀ ਮੈਂ ਇੱਧਰ ਹੀ ਜਾਣਾ ਪਰ ਹੁਣ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਅਸੀਂ ਦੇਖ ਰਹੇ ਹਾਂ ਵੀ ਪੰਦਰ੍ਹਾਂ ਸਾਲਾਂ ਦੇ ਜਿੱਥੋਂ ਮੈਂ ਆਪਣਾ ਸ਼ ਕੈਰੀਅਰ ਸ਼ੁਰੂ ਕੀਤਾ ਸੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਹਦੇ 'ਚ ਬੜਾ ਸਾਰਾ ਨਿਘਾਰ ਆ ਗਿਆ ਉਹਦੇ ਲਈ ਚਾਹੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਚਾਹੇ ਸਾਡਾ ਜਿਹੜਾ ਕਿਹਾ ਜਾਵੇ ਵੀ ਐਜੂਕੇਸ਼ਨ ਸਿਸਟਮ ਹੈ ਉਹ ਜ਼ਿੰਮੇਵਾਰ ਹੈ ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਇਹਦੇ 'ਤੇ ਅਸਰ ਪਾ ਰਹੀਆਂ ਨੇ ਦਿਨ ਪਰ ਦਿਨ ਸਾਡੇ ਹੁਣ ਜਿਹੜੀਆਂ ਹੈਗੇ ਨੇ ਬੱਚਿਆਂ ਦੀ ਗਿਣਤੀ ਘੱਟ ਰਹੀ ਆ ਪ੍ਰੋਫੈਸ਼ਨ ਕਿੱਤਿਆਂ ਵੱਲ ਜਿਹੜਾ ਬੱਚੇ ਜਾ ਨਹੀਂ ਰਹੇ ਹੈਗੇ ਬਾਹਰ ਵੱਲ ਜ਼ਿਆਦਾ ਜਾ ਰਹੇ ਨੇ ਚਾਹੇ ਕਿਤੇ ਨਾ ਕਿਤੇ ਅਸੀਂ ਕਹੀਏ ਵੀ ਇਹਦੇ ਲਈ ਸਾਡਾ ਆਪਦਾ ਦੇਸ਼ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਇੰਨੇ ਪੜ੍ਹੇ ਲਿਖੇ ਬੱਚੇ ਜਾਂ ਅਸੀਂ ਮੈਂ ਆਪ ਦੀ ਗੱਲ ਕਹਾਂ ਤਾਂ ਜਦੋਂ ਮੈਂ ਗ੍ਰੈਜੂਏਸ਼ਨ ਕਰਕੇ ਨਿਕਲੀ ਉਸ ਟਾਈਮ ਸਰਕਾਰੀ ਨੌਕਰੀ ਪੰਜ ਸਾਲ ਸੱਤ ਸਾਲ ਕੋਈ ਸਰਕਾਰੀ ਨੌਕਰੀ ਨਹੀਂ ਨਿਕਲੀ ਜਿਹਦੇ ਕਰਕੇ ਮਤਲਬ ਕਿਤੇ ਨਾ ਕਿਤੇ ਮੈਨੂੰ ਵੀ ਅੰਦਰੋਂ ਹੁੰਦਾ ਸੀਗਾ ਵੀ ਹਾਂ ਇਹ ਬੜਾ ਗਲਤ ਹੈ ਮੈਂ ਮੇਰਾ ਸੀਗਾ ਵੀ ਮੈਂ ਕਿਤੇ ਸਰਕਾਰੀ ਅੜਕ ਜਾਂ ਅਤੇ ਪਰ ਇਹ ਸਾਨੂੰ ਮੌਕਾ ਨਹੀਂ ਮਿਲਿਆ ਜਦ ਨੂੰ ਮੌਕਾ ਮਿਲਿਆ ਉਦੋਂ ਨੂੰ ਸਾਡੀ ਉਮਰ ਨਿਕਲ ਗਈ ਇਸ ਗੱਲ ਕਰਕੇ ਜਿਹੜਾ ਸੀਗਾ ਵੀ ਹਾਂ ਹੁਣ ਕਿਤੇ ਨਾ ਕਿਤੇ ਹੁਣ ਇਹਦੇ 'ਚ ਕੀ ਹੈ ਬੜੀਆਂ ਸਾਰੀਆਂ ਅੱਗੇ ਕੰਡੀਸ਼ਨਾਂ ਲੱਗੀ ਜਾਂਦੀਆਂ ਜਿਹੜੇ ਪੁਰਾਣੇ ਲੋਕ ਸੀਗੇ ਪ੍ਰੋਫੈਸਰ ਉਹ ਤਾਂ ਬੜੇ ਸੌਖੇ ਤਰੀਕੇ ਨਾਲ ਅੱਗੇ ਅੱਗੇ ਉਨ੍ਹਾਂ ਨੂੰ ਪ੍ਰਮੋਸ਼ਨਾਂ ਵੀ ਮਿਲਗੀਆਂ ਤਰੱਕੀਆਂ ਮਿਲੀ ਗਈਆਂ ਉਨ੍ਹਾਂ ਨੂੰ ਸ ਜਿਹੜੀ ਤਨਖਾਹਾਂ ਸੀ ਵੀ ਉਨ੍ਹਾਂ ਦੀ ਵਧੀਆ ਸੀਗੀਆਂ ਪਰ ਸਾਡੇ ਟਾਈਮ ਦੇ ਵਿੱਚ ਹੁਣ ਅਸੀਂ ਕਹੀਏ ਅਸੀਂ ਹਰ ਪਾਸਿਓਂ ਸੰਤੁਸ਼ਟ ਇਸ ਲਈ ਹੋ ਰਹੇ ਹਾਂ ਵੀ ਨਾ ਤਾਂ ਸਾਨੂੰ ਮਿਲਦੀ ਤਰੱਕੀ ਮਿਲੀ ਹੈ ਜਿਹੜੀ ਸਾਨੂੰ ਕਿਹਾ ਜਾਵੇ ਵੀ ਤਨਖਾਹ ਦੇ ਰੂਪ 'ਚ ਮਿਲਣੀ ਚਾਹੀਦੀ ਸੀ ਨਾ ਸਾਨੂੰ ਜਿਹੜੀਆਂ ਪ੍ਰਮੋਸ਼ਨਾਂ ਏ ਤਰੱਕੀਆਂ ਜਿਹੜੀਆਂ ਵੈਸੇ ਚਾਹੀਦੀਆਂ ਸੀ ਵੀ ਅੱਗੇ ਜਾ ਕੇ ਸੀਨੀਅਰ ਸਕੇਲ ਮਿਲਣਾ ਉਹ ਤਾਂ ਅਸੀਂ ਸੋਚ ਨਹੀਂ ਸਕਦੇ ਹੁਣ ਉਹ ਹੁਣ ਜਦੋਂ ਅਸੀਂ ਕਿਤੇ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਜੀ ਐਡਮਿਸ਼ਨਾ ਨਹੀਂ ਹੈਗੀਆਂ ਆਹ ਨੀ ਹੈਗਾ ਉਹ ਨਹੀਂ ਹੈਗਾ ਉਹਨਾਂ ਕੋਲ ਬੜੇ ਸਾਰੇ ਬਹਾਨੇ ਨੇ ਅਤੇ ਕਿਤੇ ਨਾ ਕਿਤੇ ਇਹ ਸਾਰੇ ਕਾਸੇ ਲਈ ਸਾਡਾ ਦੇਸ਼ ਸਾਡੀ ਸਰਕਾਰ ਜਾਂ ਜਿਹੜੇ ਅੰਦਰਲੇ ਸਿਸਟਮ ਨੇ ਉਹ ਜ਼ਿੰਮੇਵਾਰ ਨੇ ਜਿਹਦੇ ਕਰਕੇ ਲੋਕ ਛੱਡ ਕੇ ਆਪਦਾ ਜਿਹੜਾ ਮੇਨ ਕਿੱਤਾ ਜਿਹਨੂੰ ਮੈਂ ਬੜੇ ਸ਼ੌਂਕ ਨਾਲ ਚੁਣਿਆ ਸੀ ਉਹ ਵੀ ਅੱਜ ਮੈਨੂੰ ਬੋਝ ਲੱਗ ਰਿਹਾ ਕਿਉਂਕਿ ਜਦੋਂ ਅਸੀਂ ਜੋ ਸੋਚਦੇ ਹਾਂ ਉਹ ਪੂਰਾ ਨਹੀਂ ਹੁੰਦਾ ਤਾਂ ਸਾਨੂੰ ਲੱਗਦਾ ਵੀ ਹਾਂ ਯਾਰ ਮੇਰਾ ਡਸੀਜ਼ਨ ਇਹ ਗਲਤ ਸੀਗਾ ਮੈਨੂੰ ਇਹ ਗਲਤ ਨਹੀਂ ਸੀ ਡਸੀਜ਼ਨ ਲੈਣਾ ਚਾਹੀਦਾ ਇਹਦੀ ਥੋਂ 'ਤੇ ਜੇ ਮੈਂ ਕਿਤੇ ਕੰਪਨੀ 'ਚ ਹੁੰਦੀ ਤਾਂ ਸ਼ਾਇਦ ਮੈਨੂੰ ਹੁਣ ਤੱਕ ਬਹੁਤ ਮੈਂ ਪੈਸੇ ਕਮਾ ਚੁੱਕੀ ਹੁੰਦੀ ਚਲ ਠੀਕ ਹੈ ਥੋੜ੍ਹੀ ਬਹੁਤ ਔਖਾ ਕੱਟਣਾ ਪੈਂਦਾ ਮੇਰੇ ਘਰ ਦੇ ਫਰੰਟ ਦੇ ਉੱਤੇ ਵੀ ਹਾਂ ਮੈਂ ਥੋੜ੍ਹਾ ਜਿਹਾ ਔਖਾ ਹੋ ਲੈਂਦੀ ਪਰ ਕਿਤੇ ਨਾ ਕਿਤੇ ਮੈਨੂੰ ਇਹ ਹੋਣਾ ਸੀ ਵੀ ਹਾਂ ਮੈਂ ਪੈਸਾ ਕਮਾ ਲਿਆ ਜਾਂ ਮੈਨੂੰ ਪ੍ਰਮੋਸ਼ਨ ਮਿਲ ਗਈ ਮੈਂ ਜਿੰਨਾਂ ਪੜ੍ਹਿਆ ਸੀ ਮੈਨੂੰ ਉਹਦਾ ਮੁੱਲ ਮਿਲ ਗਿਆ ਇਸ ਕਰਕੇ ਜਿਹੜਾ ਇਹ ਮੇਰਾ ਹੈਗਾ ਪ੍ਰੋਫੈਸ਼ਨ ਹੁਣ ਮੈਨੂੰ ਕਿਤੇ ਨਾ ਇਹ ਲੱਗਦਾ ਵੀ ਮੇਰਾ ਇਹ ਗਲਤ ਡਿਸੀਜ਼ਨ ਸੀਗਾ ਮੈਨੂੰ ਕਿਸੇ ਹੋਰ ਪਾਸੇ ਲੰਘਣਾ ਚਾਹੀਦਾ ਸੀ